ਮੋਹਾਲੀ ਜ਼ਿਲ੍ਹਾ ਨੌਕਰੀਆਂ ਅਤੇ ਕੰਮ ਦਾ ਇੱਕ ਹੜ੍ਹ ਬਣ ਚੁੱਕਿਆ ਹੈ ਇੱਥੇ ਵੱਧ ਤੋਂ ਵੱਧ ਨੌਕਰੀਆਂ ਅਤੇ ਫੈਕਟਰੀਆਂ ਹਨ ਜਿਸ ਨਾਲ਼ ਲੋਕ ਆਪਣਾ ਨਿੱਜੀ ਜੀਵਨ ਜਿਉਂਦੇ ਹਨ ਜਿੱਥੋਂ ਉਹਨਾਂ ਦਾ ਰੁਜ਼ਗਾਰ ਚੱਲਦਾ ਹੈ ਮੋਹਾਲੀ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਇੱਥੇ ਬਹੁਤ ਸਾਰੀਆਂ ਫੈਕਟਰੀਆਂ ਹਨ ਅਤੇ ਉਹਨਾਂ ਦੀ ਸਾਰੀ ਦੀ ਮੈਨੁਫੈਕਚਰਿੰਗ ਇੱਥੋਂ ਹੀ ਹੁੰਦੀ ਹੈ ਜਿਵੇਂ ਕਿ ਫੈਕਟਰੀਆਂ ਬਿਜਲੀ ਦੀਆਂ ਫੈਕਟਰੀਆਂ ਕੱਪੜੇ ਦੀਆਂ ਫੈਕਟਰੀਆਂ ਇੱਥੇ ਹੀ ਮੋਹਾਲੀ ਜ਼ਿਲ੍ਹੇ ਵਿੱਚ ਹਨ ਇੱਥੇ ਹੋਰ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਹਨ ਜੋ ਕਿ ਲੋਕ ਦਿਹਾੜੀ ਕਰਦੇ ਸੀ ਉਹਨਾਂ ਨੂੰ ਫੈਕਟਰੀਆਂ ਦੇ ਵਿੱਚ ਬਹੁਤ ਹੀ ਵਧੀਆ ਸਹੂਲਤਾਂ ਮਿਲਦੀਆਂ ਹਨ ਉਹਨਾਂ ਨੂੰ ਚੰਗੀਆਂ ਤਨਖ਼ਾਹਾਂ ਇਹਨਾਂ ਫੈਕਟਰੀਆਂ ਵਿੱਚ ਮਿਲਦੀਆਂ ਹਨ ਅਤੇ ਇਸ ਦੇ ਨਾਲ਼ ਉਹਨਾਂ ਦਾ ਵਾਧਾ ਹੁੰਦਾ ਹੈ ਉਹਨਾਂ ਦੇ ਨਿੱਜੀ ਜੀਵਨ ਦੇ ਵਿੱਚ ਇਸ ਤੋਂ ਇਲਾਵਾ ਛੋਟੇ ਦੁਕਾਨਦਾਰ ਵੀ ਹਨ ਅਤੇ ਖਾਣ ਪੀਣ ਦੀਆਂ ਦੁਕਾਨਾਂ ਵੀ ਚੱਲਦੀਆਂ ਹਨ ਅਤੇ